ਪੰਜਾਬ ਵਿੱਚ ਰਾਜ ਸਰਕਾਰ ਜਿਹੜੀ ਹੈਗੀ ਹੈ ਵੈਸੇ ਤਾਂ ਉਹ ਆਪਣੇ ਦਮ 'ਤੇ ਹੀ ਕੰਮ ਕਰਦੀ ਹੈ ਲੇਕਿਨ ਉਹ ਇਕੱਲੇ ਵੀ ਕੰਮ ਨਹੀਂ ਕਰ ਸਕਦੀ ਉਸਨੂੰ ਜਿਹੜੀਆਂ ਕਿ ਸਥਾਨਕ ਸਰਕਾਰਾਂ ਹੈ ਜਿਵੇਂ ਕਿ ਨਗਰ ਪਾਲਿਕਾ ਅਤੇ ਪੰਚਾਇਤ ਹੈਗੀ ਹੈ ਉਹਨਾਂ ਦੇ ਨਾਲ ਮਿਲ ਕੇ ਹੀ ਕੰਮ ਕਰਨਾ ਪੈਂਦਾ ਹੈ ਤਾਂ ਹੀ ਉਸਦਾ ਜਿਹੜਾ ਕੰਮ ਹੈ ਉਹ ਸਿਰੇ ਚੜ੍ਹ ਸਕਦਾ ਹੈ